ਮੇਰੀ ਪਹਿਲੀ ਲਿਖਤ ਦਾ ਨਾਮ ਸੀ ਅਰਜੋਈ ਇਹ ਇੱਕ ਬਹੁਤ ਹੀ ਮਾਸੂਮ ਲੜਕੀ ਦੀ ਕਹਾਣੀ ਸੀ ਜਿਸ ਵਿੱਚ ਉਸਦੀਆਂ ਮੁਸ਼ਕਲਾਂ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਉਹ ਗਰੀਬ ਪਰਿਵਾਰ ਵਿੱਚੋਂ ਪੜ੍ਹ ਲਿਖ ਕੇ ਵੱਡੀ ਹੋਈ ਅਤੇ ਕਿਸ ਤਰ੍ਹਾਂ ਉਸ ਦਾ ਇੱਕ ਅਮੀਰ ਆ ਘਰ ਵਿੱਚ ਵਿਆਹ ਹੋ ਗਿਆ ਅਤੇ ਇਹ ਇਸ ਬਾਰੇ ਕਹਾਣੀ ਸੀ ਇਹ ਕਹਾਣੀ ਲਿਖ ਕੇ ਮੈਨੂੰ ਬਹੁਤ ਹੀ ਸਕੂਨ ਮਹਿਸੂਸ ਹੋਇਆ ਕਿ ਇੱਕ ਕੁੜੀ ਦਾ ਬਚਪਨ ਜੇ ਬਹੁਤ ਹੀ ਮਾੜਾ ਗੁਜਰ ਸਕਦਾ ਹੈ ਤਾਂ ਉਸਦਾ ਆਉਣ ਵਾਲਾ ਕੱਲ੍ਹ ਉਸ ਦੇ ਕੱਲ੍ਹ ਦੀ ਕਹਾਣੀ ਨੂੰ ਬਦਲ ਕੇ ਰੱਖ ਦਿੱਤਾ ਅਤੇ ਉਹ ਇੱਕ ਬਹੁਤ ਹੀ ਸੁਖੀ ਪਰਿਵਾਰ ਵਿੱਚ ਇੱਕ ਬਹੁਤ ਹੀ ਵਧੀਆ ਨੂੰਹ ਬਣ ਕੇ ਉਸਨੇ ਦਿਖਾਇਆ ਅਤੇ ਉਸਦਾ ਘਰ ਖੁਸ਼ਹਾਲ ਬਣਿਆ ਅਤੇ ਉਸਨੇ ਕਿਸ ਤਰ੍ਹਾਂ ਆਪਣੇ ਮਾਂ ਬਾਪ ਗਰੀਬ ਮਾਂ ਬਾਪ ਅਤੇ ਆਪਣੇ ਭੈਣ ਭਰਾਵਾਂ ਦੀ ਮਦਦ ਕਰਕੇ ਉਸ ਨੂੰ ਉੱਚਾ ਚੁੱਕਿਆ ਇਹ ਕਹਾਣੀ ਬਹੁਤ ਹੀ ਵਧੀਆ ਸੀ